ਜੇ ਕੋਈ ਵਿਅਕਤੀ ਪੈਸੇ ਵਜੋਂ ਫੋਟੋਗ੍ਰਾਫੀ ਕਰਨਾ ਚਾਹੁੰਦਾ ਹੋਵੇਗਾ ਅਤੇ ਮੇਰੀ ਉਸ ਨੂੰ ਇਹੀ ਸਲਾਹ ਹੋਏਗੀ ਕਿ ਆਹ ਕੰਮ ਉਹ ਪੂਰੇ ਜਜ਼ਬੇ ਦੇ ਨਾਲ ਕਰੇ ਕਿਉਂਕਿ ਸ਼ੁਰੂਆਤੀ ਦਿਨਾਂ ਵਿੱਚ ਉਸਨੂੰ ਬਹੁਤ ਸਾਰੀਆਂ ਅਸੁਵਿਧਾਵਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਹ ਸ਼ਾਇਦ ਇਸ ਕਰਕੇ ਫੋਟੋਗ੍ਰਾਫੀ ਨੂੰ ਅੱਧ ਵਿਚਕਾਰ ਵੀ ਛੱਡ ਸਕਦਾ ਹੈ ਇਸ ਲਈ ਮੈਂ ਉਸਨੂੰ ਇਹੀ ਸਲਾਹ ਦੇਵਾਂਗਾ ਕਿ ਤੂੰ ਇਹ ਕੰਮ ਪੂਰੇ ਜਜ਼ਬੇ ਦੇ ਨਾਲ ਕਰੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਸ ਵਿੱਚ ਬਹੁਤ ਜ਼ਿਆਦਾ ਪੈਸਾ ਹੈ ਕਿਉਂਕਿ ਅਸੀਂ ਹਰ ਆਪਣੇ ਫੰਕਸ਼ਨ 'ਤੇ ਖੁਸ਼ੀ ਦਾ ਹੋਵੇ ਜਾਂ ਫਿਰ ਦੁੱਖ ਦਾ ਹੋਵੇ ਅਸੀਂ ਫੋਟੋਗ੍ਰਾਫਰ ਨੂੰ ਜ਼ਰੂਰ ਬੁਲਾਉਂਦੇ ਹਾਂ ਅਤੇ ਇਸ ਦੇ ਉਹ ਬਹੁਤ ਸਾਰੇ ਪੈਸੇ ਮੰਗਦੇ ਹਨ ਇਸ ਲਈ ਇਹ ਆਉਣ ਵਾਲੇ ਸਮੇਂ ਵਿੱਚ ਇੱਕ ਬਹੁਤ ਵਧੀਆ ਧੰਦਾ ਹੈ